ਪੰਜਾਬ ਵਿੱਚ ਰਵਾਇਤੀ ਕਿੱਤੇ ਅਤੇ ਰੋਜ਼ੀ ਰੋਟੀ ਲਈ ਜਿਵੇਂ ਕਿ ਫੁਲਕਾਰੀ ਅਤੇ ਕਢਾਈ ਸੂਟਾਂ ਦੀ ਸਵਾਈ ਅਤੇ ਬੈਗ ਵੀ ਬਣਾਏ ਜਾਂਦੇ ਹਨ ਪੀੜੀਆਂ ਚਾਦਰਾਂ ਦਰੀਆਂ ਸਵੈਟਰ ਵੀ ਬੁਣੇ ਜਾਂਦੇ ਹਨ ਜੋ ਕਿ ਘਰ ਵਿੱਚ ਬੈਠੀਆਂ ਔਰਤਾਂ ਆਪਣੇ ਘਰ ਦੇ ਕੰਮਾਂ ਤੋਂ ਜਦੋਂ ਵਿਹਲੇ ਹੁੰਦੀਆਂ ਹਨ ਤਾਂ ਘਰ ਵਿੱਚ ਬਹਿ ਕੇ ਹੀ ਆਪਣੇ ਰੋਜ਼ੀ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵੀ ਕਰ ਲੈਂਦੀਆਂ ਹਨ ਜਿਵੇਂ ਚੁੰਨੀਆਂ 'ਤੇ ਲੈਸ ਲਗਾਉਣਾ ਕਈ ਕਈ ਇਸਤਰੀਆਂ ਐਨੀਆਂ ਹੁਸ਼ਿਆਰ ਹਨ ਜਿਵੇਂ ਕਿ ਟਿਊਸ਼ਨ ਪੜ੍ਹਾਉਣੀ ਅਤੇ ਕਈ ਘਰ ਵਿੱਚ ਬਹਿ ਕੇ ਹੀ ਅਚਾਰ ਪਾਪੜ ਆਦਿ ਦਾ ਵੀ ਵਪਾਰ ਕਰਦੀਆਂ ਹਨ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਵਿੱਚ ਵਾਧਾ ਹੋ ਸਕੇ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਣ ਅਤੇ ਆਪਣੇ ਬੱਚਿਆਂ ਦਾ ਭਵਿੱਖ ਵੀ ਸੁਧਾਰ ਸਕਣ ਇਸ ਤੋਂ ਇਲਾਵਾ ਲੋਕ ਖੇਤੀਬਾੜੀ ਵੀ ਕਰਦੀਆਂ ਹਨ ਕਿਉਂਕਿ ਸਮੇਂ ਦੀ ਤਬਦੀਲੀ ਕਾਰਨ ਹੁਣ ਖੇਤੀਬਾੜੀ ਦੇ ਵੀ ਕਾਫੀ ਵਿਸਥਾਰ ਹੋਇਆ ਹੈ ਕਈ ਨਵੇਂ ਨਵੇਂ ਤਰੀਕੇ ਨਾਲ ਲੋਕ ਖੇਤੀ ਕਰਨ ਲੱਗ ਪਏ ਹਨ ਅਤੇ ਨਵੀਂ ਪੀੜ੍ਹੀ ਵੀ ਖੇਤੀਬਾੜੀ ਦੇ ਰਿਲੇਟਿਵ ਨਵੀਂ ਸੂਚਨਾਵਾਂ ਨਾਲ ਵਿ ਖੇਤੀਬਾੜੀ ਦਾ ਵਿਕਾਸ ਕਰਦੇ ਹਨ ਇਸ ਦਾ ਨਾਮ ਸਮੇਂ ਦੀ ਤਬਦੀਲੀ ਨਾਲ ਖੇਤੀਬਾੜੀ ਵਿੱਚ ਵੀ ਵਪਾਰ ਵਿੱਚ ਵੀ ਬੜਾ ਹੀ ਵਿਕਾਸ ਹੋਇਆ ਹੈ ਇਸ ਤਰ੍ਹਾਂ ਲੋਕ ਘਰਾਂ ਵਿੱਚ ਵੀ ਆਮਦਨ ਦੇ ਸਾਧਨ ਕਰਕੇ ਢਾਬੇ ਖੋਲ੍ਹਣ ਲੱਗ ਪਏ ਹਨ ਤਾਂ ਜੋ ਉਹਨਾਂ ਦੇ ਆਮਦਨ ਦਾ ਆਮਦਨ ਵਿੱਚ ਵਾਧਾ ਹੋ ਸਕੇ ਇਸੇ ਤਰ੍ਹਾਂ ਲੋਕ ਆਟੋ ਰਿਕਸ਼ੇ ਆਦਿ ਵਾਹਨ ਵੀ ਚਲਾਉਣ ਲੱਗ ਪਏ ਹਨ ਸਮੇਂ ਦੀ ਤਬਦੀਲੀ ਦੇ ਨਾਲ ਰੁਜ਼ਗਾਰ ਵਿੱਚ ਵੀ ਕਾਫੀ ਵਾਧਾ ਹੋਇਆ ਹੈ